ਅਨੁਸ਼ਾਸਨ ਹੀ ਇੱਕ ਇਹੋ ਜਿਹਾ ਤਰੀਕਾ ਹੈ ਜੋ ਸਾਡੇ ਜੀਵਨ ਦੀ ਸਮੂਚਿਤ ਗੁਣਵਤਾ ਅਤੇ ਪੋਜ਼ੀਟਿਵ ਪ੍ਰਭਾਵ ਪਾ ਸਕਦੇ ਹਨ ਅਸੀਂ ਦੇਖ ਸਕਦੇ ਹਨ ਜਿਵੇਂ ਅਸੀਂ ਕੋਈ ਵੀ ਖੇਡ ਨੂੰ ਲਈਏ ਅਤੇ ਨਾਲ਼ ਹੀ ਨਾਲ਼ ਅਸੀਂ ਉਸ ਖੇਡ ਨੂੰ ਰੋਜ਼ ਦਿਲ ਅਤੇ ਜਾਨ ਨਾਲ ਰੋਜ਼ ਪ੍ਰੈਕਟਿਸ ਕਰੀਏ ਅ ਨਾਲ਼ ਹੀ ਨਾਲ਼ ਇਸ ਸਾਡਾ ਅਨੁਸ਼ਾਸਨ ਵੀ ਵੱਧਦਾ ਹੈ ਅਤੇ ਸਾਡੀ ਰੁਚੀ ਵੀ ਵੱਧਦੀ ਹੈ ਖੇਡ ਸਾਡੇ ਜੀਵਨ ਲਈ ਬਹੁਤ ਜ਼ਿਆਦਾ ਪ੍ਰਭਾਵਿਤ ਸਾਬਿਤ ਹੁੰਦੇ ਹਨ ਤਾਂ ਕਿਉਂਕਿ ਸਾਡਾ ਸਵੱਸਥ ਸਭ ਕੁਝ ਠੀਕ ਰਹਿੰਦਾ ਹੈ ਖੇਡ ਰਾਹੀਂ